ਪੰਜਾਬ ਵਿੱਚ ਲੋਕਾਂ ਦੁਆਰਾ ਸੱਭਿਆਚਾਰਕ ਵਿਰਾਸਤ ਨੂੰ ਬਹੁਤ ਹੀ ਚੰਗੇ ਢੰਗ ਨਾਲ ਮਨਾਇਆ ਜਾਂਦਾ ਹੈ ਹੁਣ ਵੀ ਪੰਜਾਬੀਆਂ ਨੇ ਆਪਣੀ ਸੱਭਿਆਚਾਰਕ ਵਿਰਸਾ ਵਿਰਾਸਤ ਨੂੰ ਕਾਇਮ ਰੱਖਿਆ ਹੋਇਆ ਹੈ ਜ ਸੱਭਿਆਚਾਰਕ ਵਿਰਾਸਤ ਨੂੰ ਮਨਾਉਣ ਦੇ ਲਈ ਅਸੀਂ ਸੰਤ ਕਬੀਰ ਜੀ ਦੇ ਜਿਵੇਂ ਦੋਹੇ ਸੁਣਦੇ ਹਾਂ ਅਸੀਂ ਸਸ਼ਤਰਾਂ ਦੇ ਦਰਸ਼ਨ ਕਰਨ ਲਈ ਜਾਂਦੇ ਹਾਂ ਮੀਰਾ ਬਾਈ ਜੀ ਮੀਰਾ ਬਾਈ ਜੀ ਕ ਕ੍ਰਿਸ਼ਨਾ ਜੀ ਦੀ ਭਗਤ ਸੀ ਉਸ ਬਾਰੇ ਵੀ ਕਵਿਤਾਵਾਂ ਭਜਨ ਸ਼ਬਦ ਸੁਣਦੇ ਹਾਂ ਬਹੁਤ ਸਾਰੇ ਇਕੱਠ ਕੀਤੇ ਜਾਂਦੇ ਹਨ ਉਹਨਾਂ ਦੇ ਵਿੱਚ ਸ਼ਬਦਾਂ ਦੁਆਰਾ ਭਜਨਾਂ ਦੁਆਰਾ ਅਸੀਂ ਆਪਣੀ ਵਿਰਾਸਤ ਨੂੰ ਯਾਦ ਕਰਦੇ ਹਾਂ ਅਸੀਂ ਆ ਜਿੱਦਾਂ ਕਿਸੇ ਮਿਊਜ਼ੀਅਮ ਵਿੱਚ ਜਾਂਦੇ ਹਾਂ ਤਾਂ ਉੱਥੇ ਵੀ ਅਸੀਂ ਆਪਣੀ ਪੁਰਾਣੀ ਵਿਰਾਸਤ ਦੀ ਜਿਹੜੀਆਂ ਕਲਾਕ੍ਰਿਤੀਆਂ ਨੂੰ ਦੇਖਦੇ ਹਾਂ ਮੇਲਿਆਂ ਵਿੱਚ ਵੀ ਅਸੀਂ ਇਹਨਾਂ ਦੇ ਦੋਹੇ ਸਕ ਜਿੱਦਾਂ ਸੰਤ ਕਬੀਰ ਜੀ ਦੇ ਸੁਣਦੇ ਹਾਂ ਵਿਰਾਸਤ ਨੂੰ ਹੁਣ ਵੀ ਕਾਇਮ ਰੱਖਿਆ ਹੋਇਆ ਹੈ ਧੰਨਵਾਦ